ਹਾਂ ਮੇਰੇ ਖੇਤਰ ਵਿੱਚ ਬਹੁਤ ਸਾਰੇ ਟਰੈਵਲ ਕੰਪਨੀਆਂ ਅਤੇ ਟਰੈਵਲ ਏਜੰਟ ਹਨ ਜੋ ਕਿ ਲੋਕਾਂ ਨੂੰ ਬਾਹਰ ਭੇਜਦੇ ਹਨ ਜਾਂ ਫਿਰ ਕਿਸੇ ਵੱਖਰੇ ਦੇਸ਼ ਵਿੱਚ ਭੇਜਦੇ ਹਨ ਇਹ ਏਜੰਟ ਮੁੱਖ ਤੌਰ 'ਤੇ ਹਰੇਕ ਕਿਸਮ ਦੇ ਲੋਕਾਂ ਨੂੰ ਬਾਹਰ ਭੇਜਦੇ ਹਨ ਚਾਹੇ ਉਹ ਕੋਈ ਵਿਦਿਆਰਥੀ ਹੈ ਜੋ ਬਾਹਰ ਪੜ੍ਹਾਈ ਕਰਨਾ ਚਾਹੁੰਦਾ ਹੈ ਜਾਂ ਫਿਰ ਕੋਈ ਬਾਹਰ ਘੁੰਮਣ ਜਾਂਦਾ ਜਾਣਾ ਚਾਹੁੰਦਾ ਉਹਨੂੰ ਟੂਰਿਸਟ ਵੀਜ਼ੇ 'ਤੇ ਭੇਜਦੇ ਹਨ ਜਾਂ ਕੋਈ ਕੋਈ ਜਾਂ ਕੋਈ ਵਿਆਹ ਕਰਵਾ ਕੇ ਬਾਹਰ ਰਹਿਣਾ ਚਾਹੁੰਦਾ ਹੈ ਇਹ ਇੱਕ ਇਹ ਕੰਮ ਮੋਸ਼ਟ ਜ਼ਿਆਦਾਤਰ ਏਜੰਟ ਕਰਦੇ ਹਨ ਅਤੇ ਇਨ੍ਹਾਂ ਨਾਲ ਉਨ੍ਹਾਂ ਨੂੰ ਬਹੁਤ ਇਨ੍ਹਾਂ ਨਾ ਇਨ੍ਹਾਂ ਇਸ ਨਾਲ ਉਨ੍ਹਾਂ ਨੂੰ ਪੈਸੇ ਕਮਾਉਣ ਵਿੱਚ ਬਹੁਤ ਹੀ ਆਸਾਨੀ ਹੁੰਦੀ ਹੈ ਅਤੇ ਕੁਝ ਕੰਪਨੀਆਂ ਇਹੋ ਜਿਹੀਆਂ ਹਨ ਜੋ ਕਿ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਰੱਖਦੀਆਂ ਹਨ ਜੇਕਰ ਅਸੀਂ ਕਿਸੇ ਨਵੀਂ ਜਗ੍ਹਾ 'ਤੇ ਜਾਣਾ ਹੋਵੇ ਅਤੇ ਅਸੀਂ ਉਸ ਜਗ੍ਹਾ ਬਾਰੇ ਸਾਨੂੰ ਜਾਣਕਾਰੀ ਚਾਹੀਦੀ ਹੋਵੇ ਹੁਣ ਅੱਜਕੱਲ੍ਹ ਤਾਂ ਬਹੁਤ ਸਾਰੇ ਮੋਬਾਇਲ ਫੋਨ 'ਤੇ ਐਪ ਆ ਗਏ ਹਨ ਜਿਸ ਨਾਲ ਜਿਸ ਦੀ ਵਰਤੋਂ ਨਾਲ ਅਸੀਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ